ਖੇਡਾਂ ਲੋਕਾਂ ਲਈ ਸ ਸਟ੍ਰੈੱਸ ਰਹਿਤ ਅਤੇ ਆਨੰਦਦਾਇਕ ਜੀਵਨ ਪ੍ਰਦਾਨ ਕਰਦੀਆਂ ਹਨ ਕਿਉਂਕਿ ਖੇਡਾਂ ਖੇਡਣ ਨਾਲ ਜੋ ਮਨੁੱਖ ਦਾ ਮਾਨਸਿਕ ਅਤੇ ਸਰੀਰਕ ਤਨਾਅ ਆ ਉਹ ਦੂਰ ਹੁੰਦਾ ਹੈ ਕਿਉਂਕਿ ਜਦੋਂ ਇੱਕ ਵਿਅਕਤੀ ਕੋਈ ਗੇਮ ਕਰਦਾ ਹੈ ਤਾਂ ਉਸਦਾ ਜੋ ਸਰੀਰਕ ਸਰੀਰ ਦਾ ਪਸੀਨਾ ਹੈ ਗੰਦਗੀ ਹੈ ਸਰੀਰ ਦੇ ਅੰਦਰਲੀ ਹੈ ਉਹ ਪਸੀਨੇ ਰਾਹੀਂ ਬਾਹਰ ਆਉਂਦੀ ਹੈ ਜਿਹਦੇ ਨਾਲ ਉਹਦਾ ਜੋ ਸਰੀਰ ਹੈ ਜੋ ਅੰਦਰਲਾ ਸਿਸਟਮ ਹੈ ਉਹ ਬਿਲਕੁਲ ਵਧੀਆ ਵਰਕ ਕਰਦਾ ਹੈ ਦੂਜੀ ਗੱਲ ਜਦੋਂ ਵਿਅਕਤੀ ਗੇਮ ਕਰਦਾ ਹੈ ਤਾਂ ਉਹਦਾ ਧਿਆਨ ਸਿਰਫ ਗੇਮ 'ਤੇ ਹੁੰਦਾ ਹੈ ਜਿਸ ਕਰਕੇ ਉਹ ਇੱਕ ਇੱਕ ਟਾਈਮ ਦੁਨੀਆਦਾਰੀ ਤੋਂ ਕੱਟਿਆ ਜਾਂਦਾ ਹੈ ਜਿਹਦੇ ਕਰਕੇ ਉਹਦੇ ਦਿਮਾਗ 'ਚ ਕੋਈ ਗੱਲ ਨਹੀਂ ਹੁੰਦੀ ਅਤੇ ਉਹ ਦੁਨੀਆ ਦੀਆਂ ਟੈਨਸ਼ਨਾਂ ਤੋਂ ਬਹੁਤ ਦੂਰ ਹੁੰਦਾ ਹੈ ਇਸ ਲਈ ਖੇਡਾਂ ਜੋ ਇੱਕ ਮਨੁੱਖ ਲਈ ਨੇ ਬਹੁਤ ਹੀ ਲਾਭਦਾਇਕ ਨੇ